ਵੀਡੀਓ ਕੋਂਨਫਰੈਂਸਿੰਗ ਉਹ ਹੁੰਦੀ ਹੈ ਜਿਹਦੇ ਇੱਕ ਸੇ ਉਹ ਸੇਵਾ ਹੈ ਜਿਹਦੇ ਕਰਕੇ ਕਿ ਅਸੀਂ ਦੁਨੀਆਂ ਦੇ ਹਰ ਇੱਕ ਕਿਤੇ ਅਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ ਭਾਵੇਂ ਉਹ ਬਿਜ਼ਨਸ ਦੀ ਹੈ ਭਾਵੇਂ ਉਹ ਐਜੂਕੇਸ਼ਨ ਹੈ ਭਾਵੇਂ ਉਹ ਆਪਣੀ ਪਰਸਨਲ ਗੱਲ ਹੀ ਕਿਉਂ ਨਾ ਹੋਵੇ ਅਤੇ ਜਿਵੇਂ ਕਿ ਮੈਂ ਸਕੂਲ ਟਾਈਮ ਦੇ ਵਿੱਚ ਕੋਵਿਡ ਦੌਰਾਨ ਮੈਂ ਔਨਲਾਈਨ ਕਲਾਸਿਸ ਅਟੈਂਡ ਕੀਤੀਆਂ ਸੀਗੀਆਂ ਜਿਹਦੇ ਵਿੱਚ ਕਿ ਮੈਨੂੰ ਬਹੁਤ ਜ਼ਿਆਦਾ ਸਹੀ ਸ ਸਹੀ ਫੀਲ ਹੋਇਆ ਸੀਗਾ ਕਿਉਂਕਿ ਮੈਂ ਘਰੇ ਬੈਠ ਕੇ ਹੀ ਸਕੂਲ ਦਾ ਮਾਹੌਲ ਦੇਖ ਰਿਹਾ ਸੀਗਾ ਅਤੇ ਮੈਨੂੰ ਇਹ ਸਮਝ ਆਇਆ ਕਿ ਅਸੀਂ ਘਰ ਬੈਠ ਕੇ ਵੀ ਕਿੱਦਾਂ ਪੜ੍ਹ ਸਕਦੇ ਹਾਂ ਔਨਲਾਈਨ ਕਿੱਦਾਂ ਦੂਜੇ ਨੂੰ ਪੜ੍ਹਾ ਸਕਦੇ ਹਾਂ ਦੂਜੇ ਨੂੰ ਕਿੱਦਾਂ ਸਮਝਾ ਸਕਦੇ ਹਨ ਅਤੇ ਫਿਰ ਇਹਦੇ ਬਾਅਦ ਇਹਦੇ ਮੈਨੂੰ ਨਾ ਪਸੰਦੀਦਾ ਨਾ ਪਸੰਦੀਦਾ ਵੇਜ ਆਹੀ ਲੱਗੇ ਕਿ ਪਹਿਲਾਂ ਕਿ ਜੇ ਸਾਡੇ ਕੋਲ ਨੈਟਵਰਕ ਨਾ ਹੋਵੇ ਤਾਂ ਅਸੀਂ ਵੀਡੀਓ ਕੋਂਨਫਰੈਂਸਿੰਗ ਕਰ ਹੀ ਨਹੀਂ ਸਕਦੇ ਉਹ ਇੰਪੋਸੀਬਲ ਥਿੰਗ ਹੋ ਜਾਂਦੀ ਹੈ ਅਤੇ ਜਿਵੇਂ ਅਸੀਂ ਜਿੱਦਾਂ ਕਲਾਸ ਦੇ ਵਿੱਚ ਟੀਚਰ ਤੋਂ ਕਿਸੇ ਦਾ ਡਾਊਟ ਪੁੱਛ ਲਈਏ ਅਸੀਂ ਉਹਦੇ ਵਿੱਚ ਨਹੀਂ ਕਰ ਸਕਦੇ ਸਾਨੂੰ ਉੰਨਾਂ ਵਧੀਆ ਸਮਝ ਨਹੀਂ ਆਊਗਾ ਨੈਟਵਰਕ ਇਸ਼ੂ ਕਰਕੇ ਕੋਈ ਡਿਵਾਈਸ ਇਸ਼ੂ ਕਰਕੇ ਜਾਂ ਕਦੇ ਕਦਾਰ ਇੱਦਾਂ ਹੁੰਦਾ ਹੈ ਕਿ ਸਾਡੀ ਬੈਟਰੀ ਫੋਨ ਦੀ ਖ਼ਤਮ ਹੋ ਜਾਂਦੀ ਹੈ ਜਿਹਦੇ ਕਰਕੇ ਕਿ ਉਹ ਸਾਰਾ ਕੁਛ ਹੀ ਬੰਦ ਹੋ ਜਾਂਦਾ ਵਾ ਅਤੇ ਸਾਨੂੰ ਮਤਲਬ ਬਹੁਤ ਅਲੱਗ ਮਤਲਬ ਫੀਲ ਹੁੰਦਾ ਕਿ ਅਸੀਂ ਬਹੁਤ ਪਿੱਛੇ ਰਹਿ ਚੁੱਕੇ ਹਾਂ ਬਾਕੀਆਂ ਨਾਲੋਂ ਕਿ ਉਹਨਾਂ ਨੇ ਉਹ ਸਮਝ ਲੈਣਾ ਮੈਂ ਇਹ ਨਹੀਂ ਸਮਝ ਪਾਇਆ ਇਹ ਟੋਪਿਕ ਨਹੀਂ ਸਮਝ ਪਾਇਆ